ਸਤਿ ਸ਼੍ਰੀ ਅਕਾਲ ਜੀ ਕੀ ਮੇਰੀ ਗੱਲ ਲੱਕੀ ਢਾਬੇ 'ਤੇ ਹੋ ਰਹੀ ਹੈ ਮੈਂ ਨਿੱਕੀਤਾ ਗੱਲ ਕਰ ਰਹੀ ਹਾਂ ਮੈਂ ਇੱਕ ਔਰਡਰ ਕੀਤਾ ਸੀ ਇਕ ਜਿਵੇ ਵੈੱਜ਼ ਥਾਲੀ ਤਿੰਨ ਦਾਲ ਮੱਖਣੀ ਚਾਲੀ ਰੋਟੀ ਦੋ ਕੜਾਹੀ ਪਨੀਰ ਅਤੇ ਦੋ ਰਾਈਤੇ ਅਤੇ ਮੈਂ ਉੱਥੇ ਇੰਸਟਰਕਸ਼ਨ ਪਾਈ ਸੀ ਕਿ ਮੇਰੇ ਜਿਹੜੇ ਰਾਇਤੇ ਆ ਉਹਨਾਂ ਵਿੱਚ ਜ਼ੀਰਾ ਨਾ ਪਾਇਆ ਜਾਵੇ ਅਤੇ ਅੱਗੋਂ ਮੈਂ ਇਹ ਪੁੱਛਣਾ ਸੀ ਕਿ ਤੁਸੀਂ ਇੰਸਟਰਕਸ਼ਨਸ ਨੂੰ ਫੋਲੋ ਕਰਦੇ ਹੋ ਅਤੇ ਮੈਨੂੰ ਇਹ ਕਿਵੇਂ ਪਤਾ ਲਗ ਚੱਲੇਗਾ ਕਿ ਜਿ ਜਿਹੜੀ ਮੈਂ ਇੰਸਟਰਕਸ਼ਨ ਪਾਈ ਹੈ ਤੁਸੀਂ ਉਹ ਫੋਲੋ ਕਰਦੇ ਹੋ ਜਾਂ ਨਹੀਂ ਕੀ ਪੇਮੈਂਟ ਗੂਗਲ ਪੇ ਰਾਹੀਂ ਹੋ ਸਕਦੀ ਹੈ ਧੰਨਵਾਦ ਜੀ